ਹੈਲੋ ਸ਼ਿਵ ਸ਼ਕਤੀ ਸਵੀਟਸ ਐਂਡ ਰੈਸਟੋਰੈਂਟ ਸਰਹਿੰਦ ਤੋਂ ਬੋਲ ਰਹੇ ਹੋ ਮੈਂ ਤੁਹਾਨੂੰ ਕਾਲ ਤਾਂ ਕੀਤੀ ਆ ਅੱਜ ਮੈਂ ਤੁਹਾਡੇ ਕੋਲੋਂ ਡਿਨਰ ਮੰਗਵਾਇਆ ਸੀ ਰਾਤ ਦਾ ਖਾਣਾ ਜਿਹਦੇ ਵਿੱਚ ਅਸੀਂ ਔਡਰ ਕੀਤਾ ਸੀ ਦਾਲ ਪਨੀਰ ਰੋਟੀ ਅਤੇ ਸਲਾਦ ਅਤੇ ਜਿਹਦੇ ਵਿੱਚੋਂ ਦਾਲ ਬਾਸੀ ਨਿਕਲੀ ਉਹਦੇ 'ਚੋਂ ਮੁਸ਼ਕ ਵੀ ਮਾਰਦਾ ਪਿਆ ਦੂਜੀ ਗੱਲ ਜਿਹੜਾ ਪਨੀਰ ਆ ਉਹ ਰਬੜ ਵਰਗਾ ਹੈ ਜੋ ਕਿ ਵਧੀਆ ਨਹੀਂ ਹੈ ਅਤੇ ਰੋਟੀ ਜੋ ਕਿ ਚਿੱਥੀ ਨਹੀਂ ਜਾਂਦੀ ਪਈ ਅਤੇ ਜੇ ਆਪਾਂ ਸਲਾਦ ਦੀ ਗੱਲ ਕਰੀਏ ਤਾਂ ਸਲਾਦ ਵੀ ਸਾਨੂੰ ਲੰਚ ਟਾਈਮ ਦਾ ਲੱਗਦਾ ਪਿਆ ਕਿਉਂਕਿ ਉਹ ਤਾਜ਼ਾ ਨਹੀਂ ਹੈ ਅਤੇ ਜੇ ਆਪਾਂ ਆਖਰ 'ਚ ਸਵੀਟ ਡਿਸ਼ ਦੀ ਗੱਲ ਕਰੀਏ ਤਾਂ ਜਿਹੜੀ ਸਵੀਟ ਡਿਸ਼ ਹੈ ਉਹ ਵੀ ਅਸੀਂ ਗੁਲਾਬ ਜਾਮੁਨ ਮੰਗਵਾਈ ਸੀ ਤੁਹਾਡੇ ਕੋਲੋਂ ਅਤੇ ਤੁਸੀਂ ਉਹਦੀ ਪੈਕਜਿੰਗ ਵੀ ਬਹੁਤ ਹੀ ਖਰਾਬ ਕਰੀ ਹੋਈ ਹੈ ਜਿਹਦੇ ਵਿੱਚੋਂ ਕੀ ਹੈ ਕਿ ਜੋ ਚਾਹਣੀ ਹੈ ਗੁਲਾਬ ਜਾਮੁਨ ਦਾ ਜੋ ਰਸਾ ਹੈ ਉਹ ਸਾਰਾ ਉਸ ਪੈਕਜਿੰਗ 'ਚੋਂ ਚੋ ਕੇ ਬਾਕੀ ਖਾਣਿਆਂ ਦੇ ਵਿੱਚ ਅੱਧੇ ਖਾਣੇ 'ਚ ਮਿਕਸ ਹੋਇਆ ਪਿਆ ਜਿਹਦੇ ਕਰਕੇ ਸਾਡਾ ਸਾਰਾ ਡਿਨਰ ਸੱਤਿਆਨਾਸ ਹੋ ਚੁੱਕਿਆ ਸੋ ਸਾਨੂੰ ਤੁਹਾਡੀ ਕੁਆਲਿਟੀ ਐਂਡ ਪੈਕਜਿੰਗ ਬਿਲਕੁਲ ਵੀ ਪਸੰਦ ਨਹੀਂ ਆਈ ਤਾਂ ਪਲੀਜ਼ ਆਪਣਾ ਜਿਹੜਾ ਡਿਵ ਡਿਲੀਵਰੀ ਬੋਆਏ ਆ ਉਹਨੂੰ ਵਾਪਸ ਭੇਜੋ ਅਤੇ ਰੀਫੰਡ ਚਾਹੀਦਾ ਸਾਨੂੰ